ਹਾਂਜੀ ਮੈਨੂੰ ਅਖ਼ਬਾਰ ਪੜ੍ਹਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਵਾ ਜੀ ਮੈਂ ਅਖ਼ਬਾਰ ਵਿੱਚ ਪ ਪਹੇਲੀਆਂ ਕੌਮੀਸ ਸਾਰਾ ਕੁਛ ਪੜ੍ਹਦੀ ਹਾਂ ਅਤੇ ਪਰ ਮੇਰੇ ਪੇਪਰ ਪੜ੍ਹਨਾ ਦੀ ਰੂਟੀਨ ਸਵੇਰੇ ਬੈੱਡ ਟੀ ਦੇ ਨਾਲ ਹੀ ਮੈਂ ਬੈੱਡ ਟੀ ਦੇ ਨਾਲ ਮੈਨੂੰ ਪੇਪਰ ਪੜ੍ਹਨ ਦੀ ਇੰਨੀ ਆਦਤ ਬਣ ਚੁੱਕੀ ਆ ਕਿ ਮੈਨੂੰ ਅਖ਼ਬਾਰ ਚਾਹੀਦਾ ਹੀ ਚਾਹੀਦਾ ਸਵੇਰੇ ਬੈੱਡ ਟੀ ਦੇ ਨਾਲ ਮੈਂ ਇੱਕ ਵਾਰ ਉਹਨੂੰ ਪੜ੍ਹ ਕੇ ਉਸ ਤੋਂ ਬਾਅਦ ਮੈਂ ਆਪਣਾ ਸਾਰਾ ਕੰਮ ਕਰਕੇ ਜਦੋਂ ਮੈਂ ਲੰਚ ਵਗੈਰਾ ਕਰਕੇ ਫਰੀ ਹੁੰਦੀ ਹਾਂ ਫਿਰ ਜੋ ਇੱਕ ਵਾਰ ਮੈਂ ਫਿਰ ਅਖ਼ਬਾਰ ਵਿੱਚ ਜੋ ਬਰੀਕੀ ਮੇਰਾ ਰਹਿ ਜਾਂਦਾ ਮੈਂ ਉਸ ਨੂੰ ਇੱਕ ਵਾਰ ਫਿਰ ਪੜ੍ਹਨਾ ਹੁੰਦਾ ਵਾ ਜਿਸ ਵਿੱਚ ਮੈਨੂੰ ਪਹੇਲੀਆਂ ਪੜ੍ਹਨਾ ਅਤੇ ਨਿਊਜ਼ ਖ਼ਬਰਾਂ ਵਗੈਰਾ ਪੜ੍ਹਨਾ ਮੈਨੂੰ ਬਹੁਤ ਹੀ ਆਨੰਦ ਆਉਂਦਾ ਵਾ ਕਿਉਂਕਿ ਉਹਨਾਂ ਚੀਜ਼ਾਂ ਵਿੱਚੋਂ ਆਪਾਂ ਨੂੰ ਬਹੁਤ ਕੁਛ ਜ਼ਿਆਦਾ ਸਿੱਖਣ ਨੂੰ ਵੀ ਮਿਲਦਾ ਵਾ ਆਉਣ ਵਾਲੇ ਟਾਈਮ ਲਈ ਕੁਛ ਬਹੁਤ ਵਧੀਆ ਜਾਂਚ ਮਿਲਦੀ ਆ ਕੁਛ ਤੁਹਾਨੂੰ ਸਾਡੇ ਮਨਪਸੰਦ ਚੀਜ਼ਾਂ ਦਾ ਵੀ ਸਿੱਖਣ ਦਾ ਆਨੰਦ ਮਾਣਿਆ ਜਾਂਦਾ ਵਾ ਕੁਛ ਸਾਨੂੰ ਗਿਆਨ ਆਉਂਦਾ ਇਸ ਦੁਨੀਆਂਦਾਰੀ ਬਾਰੇ ਬਹੁਤ ਕੁਛ ਚੰਗਾ ਲੱਗਦਾ ਮੈਨੂੰ ਅਖ਼ਬਾਰ ਪੜ੍ਹਨਾ